ਖੇਤੀਬਾੜੀ ਦੇ ਕੰਮ ਵਿੱਚ ਮਿਹਨਤ ਬਹੁਤ ਹੁੰਦੀ ਹੈ ਅੱਜ ਦੇ ਸਮੇਂ ਵਿੱਚ ਲੋਕ ਮਿਹਨਤ ਕਰਨਾ ਪਸੰਦ ਨਹੀਂ ਕਰਦੇ ਉਹ ਸੌਖੇ ਤੋਂ ਸੌਖਾ ਕੰਮ ਕਰਨਾ ਚਾਹੁੰਦੇ ਹਨ ਇਸ ਕਰਕੇ ਉਹ ਇਸ ਕੰਮ ਵਿੱਚ ਉਲਝਣਾ ਨਹੀਂ ਚਾਹੁੰਦੇ ਅਗਰ ਖੇਤੀਬਾੜੀ ਨਹੀਂ ਹੋਊਗੀ ਤਾਂ ਅਸੀਂ ਆਪਣਾ ਪੇਟ ਕਿਵੇਂ ਭਰ ਸਕਦੇ ਹਾਂ ਕਿਸਾਨ ਦੇ ਉੱਪਰ ਹੀ ਸਾਰਾ ਦੇਸ਼ ਨਿਰਭਰ ਕਰਦਾ ਉਹ ਅਨਾਜ ਪੈਦਾ ਕਰਦਾ ਉਸ ਦੇ ਨਾਲ ਹੀ ਦੁਕਾਨਦਾਰੀ ਚੱਲਦੀ ਹੈ ਉਸਦੇ ਨਾਲ ਹੀ ਸਾਰਾ ਸਮਾਜ ਚਲਦਾ ਹੈ ਅਤੇ ਇਸ ਤਰ੍ਹਾਂ ਸਾਨੂੰ ਖੇਤੀਬਾੜੀ ਦਾ ਜਿਹੜਾ ਮਹੱਤਵ ਆ ਉਹ ਬਹੁਤ ਵਧੀਆ ਤਰੀਕੇ ਸਮਝਣਾ ਚਾਹੀਦਾ ਕਿਉਂਕਿ ਚਾਹੇ ਅਸੀਂ ਪੜ੍ਹੇ ਲਿਖੇ ਹਾਂ ਚਾਹੇ ਅਸੀਂ ਘੱਟ ਪੜ੍ਹੇ ਹਾਂ ਲੇਕਿਨ ਖੇਤੀਬਾੜੀ ਕਰਨਾ ਵੀ ਜ਼ਰੂਰੀ ਹੈ